ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਕਪੂਰਥਲਾ 'ਚੋਂ ਬੋਲਦਾ ਜੀ ਸਰ ਆਪਾਂ ਘਰ ਬਣਾਇਆ ਸਰ ਇੱਧਰ ਮਾਡਲ ਟਾਊਨ 'ਚ ਅਤੇ ਸਰ ਅਸੀਂ ਫਾਰਮਿੰਗ ਦਾ ਕੰਮ ਕਰਵਾਉਣਾ ਜੀ ਗਾਰਡਨ ਦਾ ਬਾਲਕਨੀ ਦਾ ਤਾਂ ਮੈਨੂੰ ਤਾਂ ਇੰਨੀ ਨੌਲੇਜ ਹੈ ਨਹੀਂ ਤਾਂ ਮੈਂ ਸੋਚਿਆ ਕਿ ਮੈਂ ਬੰਦਾ ਹਾਇਰ ਕਰ ਲੈਂਦਾ ਵੀ ਆਪਾਂ ਨੂੰ ਪੂਰਾ ਸਰ ਪੂਰੀ ਸਰਵੀਸ ਚਾਹੀਦੀ ਕੰਮ ਮਤਲਬ ਸਾਰੇ ਬੂਟੇ ਵੀ ਤੁਸੀਂ ਦੇਖਣੇ ਮੈਨੂੰ ਤਾਂ ਕੋਈ ਖਾਸ ਨੋਲੇਜ ਹੈ ਨਹੀਂ ਜੀ ਅਤੇ ਬੂਟੇ ਤੋਂ ਲੈ ਕੇ ਉਹਨਾਂ ਦੀ ਸਾਰੀ ਸੰਭ ਸਾਰੀ ਸਾਂਭ ਸੰਭਾਲ ਵੀ ਸਾਰਾ ਤੁਸੀਂ ਹੀ ਦੇਖਣਾ ਤਾਂ ਉਸਦੇ ਰਿਗਾਰਡਿੰਗ ਸਾਰੀ ਡੀਟੇਲ ਲੈਣੀ ਸੀ

ਸਾਈਜ਼ ਤਾਂ ਤੁਸੀਂ ਲਗਾ ਲਉ ਕਿ ਆਪਣਾ ਹੋਣੀ ਇਹ ਜਗ੍ਹਾ ਪੰਜਾਹ ਕੁ ਪੰਜਾਹ ਕੁ ਫੁੱਟ ਦੀ ਹੋਣੀ ਪੰਜਾਹ ਪੰਜਾਹ ਸਕੁਏਅਰ ਫੁੱਟ ਦੀ ਹੋਣੀ ਜੀ ਇਹ ਕਿੰਨੇ ਬਾਏ ਦਾ ਤਾਂ ਮੈਨੂੰ ਪਤਾ ਨਹੀਂ ਜੀ ਪੰਜਾਹ ਸਕੁਏਅਰ ਫੁੱਟ ਹੈ ਤੁਸੀਂ ਲਗਾ ਬਸ ਜਗ੍ਹਾ ਤਾਂ ਬਥੇਰੀ ਆ ਮਤਲਬ ਲਾ ਲਓ ਤੁਸੀਂ ਕਿ ਸੌ ਡੇਢ ਸੌ ਬੂਟਾ ਤਾਂ ਅਰਾਮ ਨਾਲ ਲੱਗ ਸਕਦਾ ਹਾਂਜੀ ਸਪੈਸਿਕ ਦੇ ਵਿੱਚ ਆਪਣੀ ਪਹਿਲੀ ਰਿਕੁਆਇਰਮੈਂਟ ਆਹੀ ਹੈ ਜੀ ਕਿ ਆਪਾਂ ਨੂੰ ਥੋੜ੍ਹੇ ਉਹ ਬੂਟੇ ਚਾਹੀਦੇ ਜਿਸ ਨਾਲ ਇੱਕ ਤਾਂ ਫਲ ਫਰੂਟ ਵਾਲੇ ਬੂਟੇ ਚਾਹੀਦੇ ਚਾਹੀਦੇ ਨੇ ਆਪਾਂ ਨੂੰ ਜਿਵੇਂ ਅਮਰੂਦ ਦਾ ਹੋ ਗਿਆ ਜੀ ਲੀਚੀ ਦਾ ਹੋ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਨੂੰ ਖੁਸ਼ਬੂ ਵਾਲੇ ਚਾਹੀਦੇ ਨੇ ਜੀ ਇਹ ਦੋ ਬੂਟੇ ਤਾਂ ਆਪਾਂ ਨੂੰ ਰਿਕੁਾਇਰਡ ਹੀ ਨੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਕਿਸੇ ਕਲੋਨੀ ਦੇ ਵਿੱਚ ਜੋ ਕਿ ਵਧੀਆ ਜੋ ਅ ਅਲਗ ਐਲੀਗੈਂਟ ਹੋਣ ਨਾ ਬੂਟੇ ਦੇਖਣ ਨੂੰ ਵੀ ਵਧੀਆ ਲੱਗਣ ਅਤੇ ਘਰ ਦੀ ਸ਼ੋਅਕੇਸ ਵੀ ਵਧਾਉਣ ਉਹ ਵੀ ਬੂਟੇ ਤੁਸੀਂ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਉਹਦੀ ਕੋਈ ਮੈਨੂੰ ਉਹ ਨਹੀਂ ਹੈ ਅੱਛਾ ਜੀ ਹਾਂਜੀ ਹਾਂਜੀ ਐਲਓ ਬੀਰਾ ਹੋ ਗਈ ਜਾਂ ਫਿਰ ਪੱਥਰ ਚੱਟ ਦਾ ਬੂਟਾ ਵੀ ਹੈ ਉਹਦਾ ਵੀ ਜਾਂ ਫਿਰ ਤੁਲਸੀ ਹੋ ਗਈ

ਠੀਕ ਹੈ ਇਹ ਤਾਂ ਚੱਲ ਲ ਇਹ ਤਾਂ ਲਗਾ ਲਵਾਂਗੇ ਇਹਨਾਂ ਦੀ ਕੋਸਟ ਕਿਵੇਂ ਕਿੰਨਾ ਕੁ ਖਰਚਾ ਪੈਂਦਾ ਜੀ ਇਹਨਾਂ ਦਾ ਅੱਛਾ ਜੀ ਇਹ ਅੱਛਾ ਅੱਛਾ ਅਤੇ ਇਹਦੇ ਬਾਅਦ ਲਗਾਉਣ ਤੋਂ ਬਾਅਦ ਜਿਹੜੀ ਇਹਦੀ ਸਾਂਭ ਸੰਭਾਲ ਹੈ ਜਾਂ ਕੋਈ ਖਾਦ ਖੂਦ ਪਾਉਣੀ ਹੈ ਉਹ ਵੀ ਤੁਸੀਂ ਕਰਕੇ ਦਿੰਦੇ ਹੋ ਜੀ ਜਾਂ ਫਿਰ ਇਹ ਸਾਡੇ 'ਤੇ ਜ਼ਿੰਮੇਵਾਰੀ ਹੁੰਦੀ ਹੈ ਬਾਅਦ 'ਚ

ਅੱਛਾ ਜੀ ਇਸ ਤੋਂ ਵੈਸੇ ਤੁਸੀਂ ਸਾਡੀ ਕਲੋਨੀ 'ਚ ਪਹਿਲਾਂ ਕਿਤੇ ਲਗਾਏ ਨੇ ਬੂਟੇ ਤੁਸੀਂ ਐਵੇਂ ਕਿਸੇ ਘਰ 'ਚ

ਤੁਸੀਂ ਸਰਟੀਫਾਈਡ ਹੋ ਠੀਕ ਚਲੋ ਠੀਕ ਹੈ ਫਿਰ ਤਾਂ ਮੈਂ ਤੁਹਾਨੂੰ ਜ਼ਰੂਰ ਮਿਲੂੰ ਆ ਕੇ ਤੁਹਾਡੇ ਕੋਲ ਠੀਕ ਆ ਓਕੇ